ਪਿਛਲੇ ਸਾਲ ਮੇਰੇ ਪਿਤਾ ਜੀ ਬਹੁਤ ਬਿਮਾਰ ਹੋ ਗਏ ਸਨ ਉਹਨਾਂ ਨੂੰ ਦਿਲ ਦੀ ਬਿਮਾਰੀ ਲੱਗ ਗਈ ਸੀ ਡਾਕਟਰ ਨੇ ਕਿਹਾ ਕਿ ਇਹਨਾਂ ਦੇ ਪੇਸਮੇਕਰ ਪਵਾਉਣਾ ਪਏਗਾ ਅਤੇ ਇੱਕ ਦਿਨ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਏ ਮੈਂ ਉਹਨਾਂ ਨੂੰ ਜਲਦੀ ਤੋਂ ਜਲਦੀ ਡਾਕਟਰ ਕੋਲ ਲੈ ਗਈ ਡਾਕਟਰ ਨੇ ਕਿਹਾ ਕਿ ਇਹਨਾਂ ਦੀ ਹਾਲਤ ਬਹੁਤ ਖਰਾਬ ਹੈ ਜਾਂ ਤਾਂ ਤੁਸੀਂ ਪੇਸਮੇਕਰ ਪਵਾ ਲਉ ਜਾਂ ਫਿਰ ਇਹਨਾਂ ਦੇ ਆਖਰੀ ਸਾਹ ਗਿਣ ਲਉ ਮੇਰੇ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਪੇਸਮੇਕਰ ਨਹੀਂ ਪਵਾਉਣਾ ਚਾਹੁੰਦੇ ਸਨ ਉਹ ਡਰਦੇ ਸਨ ਕਿ ਕਿਧਰੇ ਇਹਨਾਂ ਨੂੰ ਕੁਝ ਹੋ ਨਾ ਜਾਵੇ ਪਰ ਮੈਨੂੰ ਡਾਕਟਰ ਨੇ ਕਿਹਾ ਕਿ ਦੋ ਹੀ ਹੱਲ ਹਨ ਜਾਂ ਤਾਂ ਪੀਸਮੇਕਰ ਪਵਾਓ ਜਾਂ ਫਿਰ ਆਖਰੀ ਸਾਹ ਗਿਣੋ ਮੈਂ ਉਸੇ ਸਮੇਂ ਫੈਸਲਾ ਕਰ ਲਿਆ ਕਿ ਮੈਂ ਇਹਨਾਂ ਦੇ ਪੇਸਮੇਕਰ ਪਵਾ ਦੇਣਾ ਹੈ ਮੈਂ ਇਹਨਾਂ ਨੂੰ ਮਰਦੇ ਹੋਏ ਨਹੀਂ ਦੇਖ ਸਕਦੀ ਤਾਂ ਮੈਂ ਸਭ ਨੂੰ ਕਿਹਾ ਕਿ ਤੁਸੀਂ ਘਰ ਜਾਉ ਅਤੇ ਮੈਂ ਆਪ ਹੀ ਇਹਨਾਂ ਦਾ ਇਲਾਜ ਕਰਵਾ ਦੇਣਾ ਮੈਂ ਉਹਨਾਂ ਨੂੰ ਪੇਸਮੇਕਰ ਪਵਾ ਦਿੱਤਾ ਅਤੇ ਬਹੁਤ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਅੱਜ ਉਹ ਬਿਲਕੁਲ ਠੀਕ ਹਨ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਉਸ ਸਮੇਂ ਜੋ ਸਹੀ ਫੈਸਲਾ ਲਿਆ ਅੱਜ ਉਸ ਦੇ ਕਰਕੇ ਹੀ ਉਹਨਾਂ ਦੀ ਜਾਨ ਬਚੀ ਹੋਈ ਹੈ ਅਤੇ ਪ੍ਰਮਾਤਮਾ ਨੇ ਵੀ ਮੇਰਾ ਸਾਥ ਦਿੱਤਾ ਅਤੇ ਇਹ ਮੇਰਾ ਇੱਕ ਉਸ ਦਿਨ ਯਾਦਗਾਰੀ ਦਿਨ ਬਣ ਗਿਆ ਜਦੋਂ ਮੈਂ ਇਹ ਸਹੀ ਫੈਸਲਾ ਲਿਆ ਸੀ